ਵੈਸੇ ਤਾਂ ਇੱਥੇ ਥੋਕਰੇਟ ਦੀਆਂ ਦੁਕਾਨਾਂ ਬਹੁਤ ਹੈ ਪਰ ਹੁਣ ਸਬਜ਼ੀ ਦੀ ਮਹਿੰਗਾਈ ਬਹੁਤ ਜ਼ਿਆਦਾ ਹੋਈ ਪਈ ਹੈ ਆਉਣ ਵਾਲੀ ਦਿਨਾਂ ਵਿੱਚ ਸਬਜ਼ੀ ਦੀ ਮਹਿੰਗਾਈ ਇੰਨੀ ਹੋਈ ਪਈ ਹੈ ਕਿ ਇੱਥੇ ਆਲੂ ਵੀ ਤੀਹ ਤੀਹ ਰੁਪਏ ਕਿਲੋ ਮਿਲੀ ਜਾਂਦੇ ਆ ਅਤੇ ਪਿਆਜ਼ ਵੀ ਚਾਲੀ ਪੰਜਾਹ ਰੁਪਏ ਮਿਲੀ ਜਾਂਦੇ ਆ ਠੀਕ ਹੈ ਜੀ ਹੁਣ ਦੱਸੋ ਜੇ ਸਬਜ਼ੀਆਂ ਲਵੇ ਤਾਂ ਬੰਦਾ ਕੱਦੂ ਵੀ ਵੇਖ ਲਓ ਤੁਸੀਂ ਸੱਠ ਸੱਠ ਰੁਪਈਏ ਕਿਲੋ ਕੱਦੂ ਮਿਲੀ ਜਾਂਦਾ ਠੀਕ ਹੈ ਜੀ ਅੱਗੇ ਆਪਾਂ ਕਹਿੰਦੇ ਸੀ ਚੱਲੋ ਘਰ ਆਲੂ ਗੰਢੇ ਬਣਾ ਲੈਂਦੇ ਹਾਂ ਉਹ ਵੀ ਆਲੂ ਗੰਢੇ ਵੀ ਤੁਸੀਂ ਵੇਖੋ ਹੁਣ ਚਾਲੀ ਚਾਲੀ ਰੁਪਏ ਕਿਲੋ ਆਲੂ ਗੰਢੇ ਮਿਲੀ ਜਾਂਦੇ ਆ ਕੀ ਬੰਦਾ ਬਣਾਵੇ ਦਾਲਾਂ ਵੀ ਤਾਂ ਦਾਲਾਂ ਵੀ ਐਡੀਆਂ ਮਹਿੰਗੀਆਂ ਹੋਈਆਂ ਪਈਆਂ ਅੱਜ ਕੱਲ੍ਹ ਦੀ ਮਹਿੰਗਾਈ ਵਿੱਚ ਹੁਣ ਕੀ ਗਰੀਬ ਬੰਦਾ ਕੀ ਖਾਵੇ ਅਤੇ ਕੀ ਕਰੇ ਦੱਸੋ

ਔਨਲਾਈਨ ਦਾ ਕੰਮ ਔਨਲਾਈਨ ਦੇਖੋ ਹੁਣ ਆਪਾਂ ਘਰ ਇਹ ਕੰਮ ਬਹੁਤ ਵਧੀਆ ਔਨਲਾਈਨ ਦਾ ਆਪਾਂ ਘਰੇ ਬੈਠੇ ਚੀਜ਼ਾਂ ਆਰਡਰ ਕਰ ਦਿੰਦੇ ਹਾਂ ਬਾਜ਼ਾਰ ਜਾਣ ਦੀ ਲੋੜ ਹੀ ਨਹੀਂ ਠੀਕ ਹੈ ਜੀ ਪਰ ਔਨਲਾਈਨ ਇਹ ਹੈ ਕਿ ਔਨਲਾਈਨ ਦਾ ਕ ਕੱਪੜੇ ਦਾ ਮ ਥੋੜ੍ਹਾ ਜਿਹਾ ਸ ਵੀ ਪਤਾ ਨਹੀਂ ਲੱਗਦਾ ਕੱਪੜੇ ਦਾ ਥੋੜ੍ਹਾ ਜਿਹਾ ਕੰਮ ਸਹੀ ਨਹੀਂ ਹੈਗਾ ਇਹ ਸਹੀ ਨਹੀਂ ਆਉਂਦਾ ਠੀਕ ਹੈ ਆਪਾਂ ਆਰਡਰ ਹੋਰ ਕਰਦੇ ਹਾਂ ਕੱਪੜਾ ਹੋਰ ਭੇਜ ਦਿੰਦੇ ਆ ਉਹ ਜਿਹੜਾ ਕਿ ਕੱਪੜੇ ਇੱਥੇ ਆਉਣ ਕਰਕੇ ਉਹ ਸਹੀ ਨਹੀਂ ਲੱਗਦਾ ਗਾ